ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਬ ਇੰਸਪੈਕਟਰ ਜੋਤੀ ਕੌਰ ਨਾਲ ਹੀ ਗੱਲ ਕਰਨ ਦੇ ਜੀ ਦੱਸੋ ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਤੁਸੀਂ ਉਹਨਾਂ ਦਾ ਐਡਰੈਸ ਲਗਾ ਦਿਓ ਹਾਂਜੀ ਹਾਂਜੀ ਠੀਕ ਹੈ ਹਾਂਜੀ ਮੈਂ ਉੱਥੋਂ ਕੋਸ਼ਿਸ਼ ਕਰਦੀ ਹਾਂ ਜਲਦ ਤੋਂ ਜਲਦ ਤੋਂ ਉੱਥੇ ਸਭ ਕੇ ਆਪਣੇ ਜੋ ਵੀ ਔਫਿਸਰਜ਼ ਹੈ ਉਹਨਾਂ ਨੂੰ ਭੇਜਦੀ ਹਾਂ ਅਤੇ ਉੱਥੇ ਤੁਹਾਡੀ ਮਦਦ ਕਰਾਂਉਦੀ ਹਾਂ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਤੁਸੀਂ ਧੰਨਵਾਦ ਤੁਹਾਡਾ ਮੈਂ ਤੁਹਾਨੂੰ ਹੁਣੇ ਜਲਦ ਤੋਂ ਜਲਦ ਤੋਂ ਉਹਨਾਂ ਤੋਂ ਪ ਭੇਜਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ